ਬਰਤਨ ਧੋਣ ਲਈ ਵੱਖ ਵੱਖ ਪ੍ਰਕਿਰਆ ਹੁੰਦੀਆਂ ਹਨ ਇਸ ਲਈ ਬਰਤਨ 'ਤੇ ਡਿਪੈਂਡ ਕਰਦਾ ਹੈ ਕਿ ਬਰਤਨ ਕਿਹੋ ਜਿਹਾ ਹੈ ਬਰਤਨ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਚੀਨੀ ਦੇ ਤਾਂਬੇ ਦੇ ਲੋਹੇ ਦੇ ਸਟੀਲ ਦੇ ਆਦਿ ਹੁੰਦੇ ਹਨ ਅਤੇ ਅਲੱਗ ਅਲੱਗ ਬਰਤਨ ਨੂੰ ਸਾਫ਼ ਕਰਨ ਲਈ ਅਲੱਗ ਅਲੱਗ ਪ੍ਰਕਿਰਿਆ ਹੀ ਵਰਤੀਆਂ ਜਾਂਦੀਆਂ ਹਨ ਅਤੇ ਇਹ ਆਮ ਤੌਰ 'ਤੇ ਲੋਕਾਂ ਦੁਆਰਾ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਚੀਨੀ ਦੇ ਬਰਤਨ ਨੂੰ ਬੜੇ ਹੀ ਸੰਭਾਲ ਦੇ ਨਾਲ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਸਾਫ਼ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਤਾਂਬੇ ਦੇ ਬਰਤਨ ਨੂੰ ਥੋੜ੍ਹੀ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਸਟੀਲ ਅਤੇ ਦੂਜੇ ਤਰ੍ਹਾਂ ਦੇ ਬਰਤਨਾਂ ਨੂੰ ਇੰਨੀ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ ਅਤੇ ਤੇਲ ਵਾਲੇ ਬਰਤਨਾਂ ਨੂੰ ਸਾਫ਼ ਕਰਨ ਲਈ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਹਨ ਜਿਵੇਂ ਕਿ ਗਰਮ ਪਾਣੀ ਅਤੇ ਉਸ ਤੋਂ ਇਲਾਵਾ ਵਧੀਆ ਕੁਆਲਿਟੀ ਦੇ ਬਰਤਨ ਬਾਰ ਆਦਿ ਵਰਤੇ ਜਾਂਦੇ ਹਨ ਇਸ ਤੋਂ ਇਲਾਵਾ ਸੁਆਹ ਆਦਿ ਨਾਲ ਵੀ ਆਪਾਂ ਗਰਮ ਪਾਣੀ ਦੇ ਬਰਤਨਾਂ ਨੂੰ ਸਾਫ਼ ਕਰ ਸਕਦੇ ਹਾਂ ਔਰ ਹੋਰ ਬਰਤਨਾਂ ਨੂੰ ਸਾਫ਼ ਕਰਨ ਲਈ ਨਿੰਬੂ ਅਤੇ ਲੱਸੀ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਫਿਰ ਵੀ ਜੇ ਨਾ ਸਾਫ਼ ਸਫਾਈ ਹੋਵੇ ਅਤੇ ਇਸ ਨੂੰ ਚਿਕਨਾਹਟ ਨੂੰ ਚੰਗੀ ਤਰ੍ਹਾਂ ਉਤਾਰਨ ਲਈ ਵਿਨੇਗਰ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਇਸ ਲਈ ਗਰਮ ਪਾਣੀ ਨੂੰ ਇਸਤੇਮਾ ਗਰ ਤੇਲ ਵਾਲੇ ਬਰਤਨਾਂ ਨੂੰ ਸਾਫ਼ ਕਰਨ ਲਈ ਅੱਛੀ ਕੁਆਲਿਟੀ ਦੇ ਬਰਤਨ ਬਾਰ ਦੀ ਇਸਤੇਮਾਲ ਗਰਮ ਪਾਣੀ ਦਾ ਸਵਾਹ ਦਾ ਅਤੇ ਨਿੰਬੂ ਲੱਸੀ ਦਾ ਇਸਤੇਮਾਲ ਕਰਕੇ ਆਪਾਂ ਉਸ ਦੀ ਚਿਕਨਾਟ ਨੂੰ ਉਤਾਰ ਸਕਦੇ ਹਾਂ ਅਤੇ ਬਰਤਨ ਨੂੰ ਅੱਛੇ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੋ ਤਾਂਬੇ ਦੇ ਬਰਤਨ ਹੁੰਦੇ ਹਨ ਉਸ ਤੋਂ ਤੇਲ ਉਤਾਰਨ ਲਈ ਨਿੰਬੂ ਅਤੇ ਲੱਸੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਜੇ ਚਿਕਨਾਹਟ ਨਾ ਉਤਰੇ ਤਾਂ ਉਸਤੇ ਆਪਾਂ ਵਿਨੇਗਰ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਧੰਨਵਾਦ